ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਂ ਹਾਂਜੀ ਹਾਂਜੀ ਮੈਮ ਇੱਥੇ ਤੁਹਾਨੂੰ ਪਤਾ ਇਹ ਰਾਜੇ ਮਹਾਰਾਜਿਆਂ ਦਾ ਸ਼ਹਿਰ ਹੈ ਇੱਕ ਇਤਿਹਾਸਿਕ ਸ਼ਹਿਰ ਹੈ ਰਿਆਸਤ ਵੀ ਰਿਹਾ ਹੈ ਪਟਿਆਲਾ ਹਾਂਜੀ ਅਤੇ ਇੱਥੇ ਇੱਕ ਤਾਂ ਇਤਿਹਾਸਿਕ ਥਾਵਾਂ ਵੇਖਣ ਵਾਲੀਆਂ ਨੇ ਉਸ ਤੋਂ ਇਲਾਵਾ ਧਾਰਮਿਕ ਥ ਜਿਹੜੀਆਂ ਹੈਗੀਆਂ ਨੇ ਥਾਵਾਂ ਦੇਖਣ ਵਾਲੀਆਂ ਨੇ ਅਤੇ ਨਾਲ ਹੀ ਵਿੱਦਿਅਕ ਸੰਸਥਾਵਾਂ ਜਿਹੜੀਆਂ ਇੱਥੇ ਹੈਗੀਆਂ ਨੇ ਯੂਨੀਵਰਸਿਟੀਆਂ ਅਤੇ ਕਾਲਜ ਕੁਛ ਹੈਗੇ ਨੇ ਉਹ ਦੇਖਣ ਯੋਗ ਨੇ ਹਾਂਜੀ ਅਤੇ ਧਾਰਮਿਕ ਜਿਹੜੇ ਹੈਗੇ ਆ ਉਹਦੇ ਵਿੱਚ ਇੱਥੇ ਹੈਗੀਆਂ ਧਾਰਮਿਕ ਥਾਵਾਂ 'ਚ ਸ਼੍ਰੀ ਦੁੱਖ ਨਿਵਾਰਨ ਸਾਹਿਬ ਹੈਗਾ ਹੈ ਨੌਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ ਉਹ ਵੇਖ ਸਕਦੇ ਹੋ ਤੁਸੀਂ ਅਤੇ ਇੱਕ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਸ਼੍ਰੀ ਮੋਤੀ ਬਾਗ ਸਾਹਿਬ ਉਹ ਵੀ ਨੌਵੇਂ ਪਾਤਸ਼ਾਹੀ ਦਾ ਉੱਥੇ ਗੁਰੂ ਤੇਗ ਬਹਾਦਰ ਜੀ ਜਿਹੜੇ ਉਹ ਆਏ ਸੀਗੇ ਉਹ ਦੇਖ ਸਕਦੇ ਹੋ ਤੁਸੀਂ ਅਤੇ ਇਸ ਤੋਂ ਇਲਾਵਾ ਇੱਕ ਇੱਥੇ ਮੰਦਰ ਹੈਗਾ ਕਾਲੀ ਦੇਵੀ ਦਾ ਮੰਦਰ ਉਹ ਵੀ ਪ੍ਰਸਿੱਧ ਥਾਂ ਆ ਉਹ ਵੇਖ ਸਕਦੇ ਹੋ ਤੁਸੀਂ ਹਾਂਜੀ ਅਤੇ ਵਿੱਦਿਅਕ ਸੰਸਥਾਵਾਂ ਦੇ ਵਿੱਚ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਅਤੇ ਇੱਕ ਇੱਥੇ ਸਪੋਰਟਸ ਯੂਨੀਵਰਸਿਟੀ ਹੈ ਅਤੇ ਇੱਕ ਇੱਥੇ ਲੋਅ ਯੂਨੀਵਰਸਿਟੀ ਹੈ ਅਤੇ ਇੱਕ ਇੱਥੇ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਹੈ ਉਹ ਤੁਸੀਂ ਵਿਜ਼ਿਟ ਕਰ ਸਕਦੇ ਓਂ ਅਤੇ ਖੇਡਾਂ ਦੇ ਵਿੱਚ ਇੱਥੇ ਭਾਰਤ ਦਾ ਜਿਹੜਾ ਅਦਾਰਾ ਹੈਗਾ ਐੱਨ ਆਈ ਐੱਸ ਉਹ ਵੇਖ ਸਕਦੇ ਹੋ ਤੁਸੀਂ ਅਤੇ ਉਹਦੇ ਨਾਲ ਹੀ ਇੱਥੇ ਇੱਕ ਫਿਜ਼ੀਕਲ ਕਾਲਜ ਆ ਉਹ ਵੇਖ ਸਕਦੇ ਅਤੇ ਤੁਸੀਂ ਖੇਡਾਂ ਦੇ ਸੰਬੰਧ ਦੇ ਵਿੱਚ ਅਤੇ ਇਸ ਤੋਂ ਇਲਾਵਾ ਕੋਲਜ ਇੱਥੇ ਬਹੁਤ ਇਤਿਹਾਸਿਕ ਕੋਲਜ ਹੈ ਸਰਕਾਰੀ ਮਹਿੰਦਰਾ ਕੋਲਜ ਉਹ ਦੇਖ ਸਕਦੇ ਹੋ ਤੁਸੀਂ ਉਹ ਵੀ ਰਾਜੇ ਨੇ ਬਣਵਾਇਆ ਹੋਇਆ ਆਪਣੇ ਸਮੇਂ ਦੇ ਵਿੱਚ ਹਾਂਜੀ ਅਤੇ ਇੱਕ ਭਾਸ਼ਾ ਵਿਭਾਗ ਪੰਜਾਬ ਦਾ ਅਦਾ ਅਦਾਰਾ ਇੱਥੇ ਪੰਜਾਬ ਲੈਵਲ ਦਾ ਉਹ ਵੇਖ ਸਕਦੇ ਹੋ ਤੁਸੀਂ ਇੱਕ ਸੈਂਟਰਲ ਲਾਈਬ੍ਰੇਰੀ ਆ ਉਹ ਵੇਖ ਸਕਦੇ ਹੋ ਤੁਸੀਂ ਅਤੇ ਇਸ ਤੋਂ ਇਲਾਵਾ ਇੱਕ ਡੀਅਰ ਪਾਰਕ ਇੱਥੇ ਉਹ ਵੇਖ ਸਕਦੇ ਹੋ ਤੁਸੀਂ ਹਾਂਜੀ ਅਤੇ ਸੀਸ਼ ਮਹਿਲ ਹੈ ਜਿਹੜਾ ਉਹ ਵੇਖ ਸਕਦੇ ਹੋ ਤੁਸੀਂ ਉਹ ਰਾਜੇ ਨੇ ਜਿਹੜਾ ਬਣਵਾਇਆ ਹੋਇਆ ਹੈਗਾ ਹੈ ਹਾਂਜੀ ਹਾਂਜੀ ਕਿਉਂਕਿ ਇਤਿਹਾਸਿਕ ਸ਼ਹਿਰ ਹੋਣ ਕਰਕੇ ਇੱਥੇ ਕਾਫੀ ਸਾਰੀਆਂ ਜਿਹੜੀਆਂ ਪ੍ਰਸਿੱਧ ਥਾਵਾਂ ਹੈਗੀਆਂ ਨੇ ਵੇਖਣ ਯੋਗ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਵੈਲਕਮ